ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਸਰ ਸਾਡੇ ਇਥੇ ਅ ਮਤਲਬ ਚੱਲਦੇ ਰਹਿੰਦੇ ਨੇ ਸਪੋਰਟਸ ਦਾ ਯੋਗਾ ਏ ਜਿਹਦੇ ਵਿੱਚ ਸਾਡੀਆਂ ਕਾਫੀ ਐਕਟੀਵਿਟੀਜ਼ ਚੱਲਦੀਆਂ ਰਹਿੰਦੀਆਂ ਨੇ ਤੁਹਾਡਾ ਬੱਚਾ ਕਿੰਨੀ ਦੇਰ ਦਾ ਛੇ ਸਾਲ ਦਾ ਹਾਂਜੀ ਸਰ ਜਿਸ ਤਰ੍ਹਾਂ ਉਹ ਸਵੀਮਿੰਗ ਕਲਾਸਿਸ ਤੁਸੀਂ ਜੁਆਇੰਨ ਕਰਾ ਸਕਦੇ ਹੋ ਸਕੇਟਿੰਗ ਕਲਾਸ ਜੁਆਇੰਨ ਕਰਵਾ ਸਕਦੇ ਹੋ ਨਾਲ ਦੀ ਨਾਲ ਸਾਡੀ ਟੇਬਲ ਟੈਨਿਸ ਹੈ ਚੱਲੋ ਉਹ ਤਾਂ ਫਿਲਹਾਲ ਉਹਦੇ ਲਈ ਛੋਟਾ ਹੈ ਅਤੇ ਹਾਂਜੀ ਸਰ ਸਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਵੀਮਿੰਗ ਕਲਾਸਿਸ ਵੀ ਹੈਗੀ ਆ ਇੱਕ ਘੰਟਾ ਔਰ ਇੱਕ ਮਹੀਨੇ ਦਾ ਆਪਾਂ ਚਾਰ ਹਜ਼ਾਰ ਅ ਚਾਰਜ ਕਰਦੇ ਹਾਂ ਅਤੇ ਸਰ ਅਸੀਂ ਤੁਹਾਨੂੰ ਹਫਤੇ ਲਈ ਟਰਾਇਲ ਹਫਤੇ ਲਈ ਟਰਾਇਲ ਦੇਵਾਂਗੇ ਸਵੀਮਿੰਗ ਲਈ ਔਰ ਸਕੇਟਿੰਗ ਲਈ ਕੋਈ ਟਰਾਇਲ ਨਹੀਂ ਹੈਗੀ ਉਹਦੀ ਤੁਹਾਨੂੰ ਫੀਸ ਪੇ ਕਰਨੀ ਪੈਣੀ ਆ ਠੀਕ ਹੈ ਉਹਦੇ ਲਈ ਜਿਸ ਤਰ੍ਹਾਂ ਰਹੇਗੀ ਕਿ ਵੀ ਇੱਕ ਮਹੀਨੇ ਦਾ ਪੈਂਤੀ ਸੌ ਰੁਪਇਆ ਠੀਕ ਹੈ ਔਰ ਅਗਰ ਤੁਸੀਂ ਟੇਬਲ ਟੈਨਿਸ ਦੀ ਗੱਲ ਕਰੋ ਸਰ ਟੇਬਲ ਟੈਨਿਸ ਦਾ ਮੈਂ ਤਾਂ ਕਹਿ ਰਹੀ ਸੀ ਕਿ ਜੇ ਉਹਦੀ ਟੇਬਲ ਟੈਨਿਸ ਦੀ ਹਾਈਟ ਉੱਪਰ ਹੈ ਔਰ ਬੱਚੇ ਦੀ ਹਾਈਟ ਨੀਚੇ ਰਹਿ ਜਾਂਦੀ ਹੈ ਓਕੇ ਚਲੋ ਸਰ ਉਹ ਟਰਾਈਲ ਕਰ ਲਵਾਂਗੇ ਮੈਨੂੰ ਉਹ 'ਚ ਥੋੜ੍ਹਾ ਜਿਹਾ ਡਾਊਟ ਲੱਗਦਾ ਹਾਂ ਹਾਂਜੀ ਸਰ ਬਾਕੀ ਜਿਸ ਤਰ੍ਹਾਂ ਹਾਂ ਸਭ ਸਭ ਸਭ ਅਵੇਲੇਟਲ ਹੈ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਕਲੱਬ ਹੈ ਔਰ ਜਿਸ ਤਰ੍ਹਾਂ ਸਾਡਾ ਛੋਟਾ ਬੱਚਾ ਔਰ ਹਰ ਫੈਸਟੀਵਲ ਜਿਸ ਤਰ੍ਹਾਂ ਆਪਾਂ ਕਾਫੀ ਅ ਮਤਲਬ ਮਨਾ ਲਈ ਦਾ ਬ ਬੱਚੇ ਦੇ ਹਿਸਾਬ ਦੇ ਨਾਲ ਬਿਲਕੁਲ ਸਰ ਕੈਮਰੇ ਰਹਿਣਗੇ ਹਾਂਜੀ ਔਰ ਕੈਮਰਿਆਂ ਦਾ ਜਿਸ ਤਰ੍ਹਾਂ ਵਿਜ਼ੀ ਵਿਜ਼ੀਬਿਲਟੀ ਤੁਹਾਡੇ ਫੋਨ ਦੇ ਨਾਲ ਵੀ ਆਪਾਂ ਕਨੈਕਟ ਕਰ ਸਕਦੇ ਹਾਂ ਤੁਸੀਂ ਘਰ ਬੈਠੇ ਆਪਣਾ ਬੱਚਾ ਦੇਖ ਸਕਦੇ ਹੋ ਕਿ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਸਾਨੂੰ ਹਾਂ ਹਾਂਜੀ ਸਰ ਤੁਸੀਂ ਹਫਤੇ ਲਈ ਐਂ ਟਰਾਇਲ ਲੈ ਕੇ ਦੇਖ ਲੈਣਾ ਨਹੀਂ ਸਰ ਹਾਂਜੀ ਡਿਸਕਾਊਂਟ ਦਾ ਨਹੀਂ ਹੋ ਸਕਦਾ ਠੀਕ ਹੈ ਸਰ